ਸਾਡੇ ਖੇਤਰ ਦੇ ਵਿੱਚ ਮਸ਼ਹੂਰ ਸਿਨੇਮਾ ਸੂਰਜ ਚੰਦਾ ਤਾਰਾ ਟਾਕੀਜ਼ ਹੈ ਜੋ ਕਿ ਬੱਸ ਸਟੈਂਡ ਦੇ ਲਾਗੇ ਹੈ ਇਸਦਾ ਨਾਂ ਹੁਣ ਬਦਲ ਕੇ ਪੀ ਵੀ ਆਰ ਸਿਨੇਮਾਜ਼ ਰੱਖ ਦਿੱਤਾ ਗਿਆ ਹੈ ਅਸੀਂ ਬੜੇ ਪੁਰਾਣੇ ਸਮੇਂ ਤੋਂ ਜਦੋਂ ਅਸੀਂ ਸ਼ਹਿਰ ਆਉਂਦੇ ਸੀ ਤਾਂ ਬੱਸ ਸਟੈਂਡ ਦੇ ਲਾਗੇ ਹੋਣ ਕਰਕੇ ਇੱਥੇ ਫਿਲਮਾਂ ਵੇਖਣ ਲਈ ਰੁ ਚਲੇ ਜਾਂਦੇ ਸੀ ਅਤੇ ਹੁਣ ਵੀ ਜਦੋਂ ਵੀ ਕੋਈ ਚੰਗੀ ਫਿਲਮ ਲੱਗਦੀ ਹੈ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੇ ਨਾਲ ਅਸੀਂ ਇ ਇੱਥੇ ਫਿਲਮ ਵੇਖਣ ਜਾਂਦੇ ਹਾਂ ਸ਼ਹਿਰ ਦੇ ਵਿੱਚ ਹੋਰ ਵੀ ਥੀਏਟਰ ਨੇ ਪਰ ਅਸੀਂ ਇਹਨੂੰ ਪ੍ਰੇਫਰ ਕਰਦੇ ਹਾਂ ਕਿਉਂਕਿ ਇਹਦੇ ਨਾਲ ਕੁਝ ਆਪਣਾ ਪੁਰਾਣਾ ਲਗਾਵ ਜੁੜਿਆ ਹੋਇਆ ਹੈ